ਅੱਜ ਕੱਲ੍ਹ ਮੈਂ ਬਹੁਤ ਅਲੱਗ ਅਲੱਗ ਚੀਜ਼ਾਂ ਆ ਔਡਰ ਕਰਦਾ ਹੈ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਮਦਦ ਹੁੰਦੀ ਆ ਮੇਰਾ ਟਾਈਮ ਬਚਣ ਦੀ ਪਰ ਅਕਸਰ ਮੈਂ ਪ ਪੀਜ਼ਾ ਖਾਣ 'ਚ ਖੁਸ਼ ਰਹਿਣਾ ਹੈ ਕਿਉਂਕਿ ਪੀਜ਼ਾ ਬਹੁਤ ਵਧੀਆ ਚੀਜ਼ ਹੈ ਅਤੇ ਇਹ ਬਾਹਰ ਵਾਲੀ ਚੀਜ਼ ਹੈ ਤਾਂ ਮੈਂ ਅ ਪਿਛਲੇ ਹਫ਼ਤੇ ਇੱਕ ਯੂਕੇ ਪੀਜ਼ਾ ਵਾਲਿਆਂ ਤੋਂ ਪੀਜ਼ਾ ਔਡਰ ਕੀਤਾ ਸੀਗਾ ਜੋ ਸਾਡੇ ਘਰ ਦੇ ਜਮਾਂ ਹੀ ਨਜ਼ਦੀਕ ਹੈ ਅਤੇ ਉਹ ਨਵੀਂ ਦੁਕਾਨ ਖੁੱਲ੍ਹੀ ਸੀਗੀ ਮੈਨੂੰ ਸੁਣਨ 'ਚ ਆਇਆ ਹੈ ਕਿ ਉਹ ਪੀਜ਼ੇ ਬਹੁਤ ਵਧੀਆ ਬਣਾਉਂਦੇ ਆ ਅਤੇ ਮੈਂ ਵੀ ਉਹਨਾਂ ਦਾ ਪੀਜ਼ਾ ਖਾਣਾ ਚਾਹੁੰਦਾ ਸੀਗਾ ਕਿਉਂਕਿ ਮੈਂ ਕਦੀ ਵੀ ਯੂਕੇ ਪੀਜ਼ਾ ਵਾਲਿਆਂ ਦਾ ਪੀਜ਼ਾ ਨਹੀਂ ਖਾਧਾ ਅਤੇ ਉੱਥੋਂ ਜਦੋਂ ਔਨਲਾਈਨ ਔਡਰ ਕਰਕੇ ਮੈਨੂੰ ਇੱਕ ਪੀਜ਼ਾ ਮਿਲਿਆ ਅਤੇ ਪੀਜ਼ਾ ਬਹੁਤ ਸਵਾਦ ਸੀਗਾ ਅਤੇ ਪੀਜ਼ੇ ਦੇ ਨਾਲ ਸਾਨੂੰ ਮੈਨੂੰ ਇੱਕ ਹੋਰ ਡਿਸਕਾਊਂਟ ਕੂਪਨ ਮਿਲਿਆ ਅਤੇ ਮੈਂ ਕੂਪਨ ਦੇਖ ਕੇ ਬਹੁਤ ਖੁਸ਼ ਹੋ ਗਿਆ ਕਿਉਂਕਿ ਉੱਥੇ ਲਿਖਿਆ ਸੀਗਾ ਕਿ ਇੱਕ ਦੇ ਨਾਲ ਇੱਕ ਪੀਜ਼ਾ ਮੁਫ਼ਤ ਪਾਓ ਤੋ ਉਹਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋ ਗਿਆ ਅਤੇ ਉਸ ਤੋਂ ਬਾਅਦ ਫਿਰ ਮੈਂ ਅਗਲੇ ਹਫ਼ਤੇ ਫ਼ੋਨ ਲਾਇਆ ਕਿਉਂ ਮੇਰੇ ਦੋਸਤਾਂ ਨੇ ਪਲੈਨ ਬਣਾਇਆ ਕਿ ਆਪਾਂ ਪੀਜ਼ਾ ਖਾਈਏ ਤੋ ਪਲੈਨ ਤਾਂ ਪਲੈਨ ਬਣਨ ਤੋਂ ਬਾਚੋਂ ਮੈਂ ਉਹਨਾਂ ਨੂੰ ਫ਼ੋਨ ਲਾਇਆ ਅਤੇ ਉਹਨਾਂ ਨੂੰ ਮੈਂ ਕਿਹਾ ਕਿ ਯੂਕੇ ਪੀਜ਼ੇ ਤੋਂ ਬੋਲਦੇ ਕਹਿੰਦੇ ਜੀ ਹਾਂ ਅਤੇ ਉਸ ਤੋਂ ਬਾਅਦ 'ਚ ਮੈਂ ਉਹਨਾਂ ਨੂੰ ਟੋਟਲ ਦੱਸਿਆ ਕਿ ਮੈਨੂੰ ਇੱਕ ਕੂਪਨ ਮਿਲਿਆ ਉਹਦੇ ਨਾਲ ਇੱਕ ਪੀਜ਼ਾ ਫਰੀ ਮਿਲੂਗਾ ਅਤੇ ਐਵੇਂ ਸੁਣਨ ਤੋਂ ਬਾਅਦ 'ਚ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਕੋਡ ਨੰਬਰ ਦੱਸੋ ਅਤੇ ਮੈਂ ਕੋਡ ਨੰਬਰ ਦੱਸ ਤਾ ਅਤੇ ਉਸ ਤੋਂ ਬਾਅਦ 'ਚ ਉਹਨਾਂ ਨੇ ਮੈਨੂੰ ਇੱਕ ਪੀਜ਼ਾ ਫਰੀ ਮਿਲ ਗਿਆ ਅਤੇ ਮੈਨੂੰ ਪੀਜ਼ੇ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਹ ਜਮਾ ਹੀ ਮੁਫ਼ਤ ਸੀਗਾ ਅਤੇ ਉਹਦਾ ਲਾਰਜ਼ ਸਾਈਜ਼ ਸੀਗਾ ਅਤੇ ਮੈਂ ਬਹੁਤ ਖੁਸ਼ ਹੋਉਂਗਾ ਕਿ ਐਵੇਂ ਯੂਕੇ ਪੀਜ਼ਾ ਦੇ ਸਾਰਿਆਂ ਨੂੰ ਕੂਪਨ ਦਿੰਦੇ ਰਹਿਣ ਕਿਉਂਕਿ ਆਹੀ ਬਹੁਤ ਵਧੀਆ ਚੀਜ਼ ਆ ਕਿ ਉਹਨਾਂ ਦੀ ਸੇਲ ਵੀ ਵਧੂ ਇਹਨਾਂ ਨਾਲ ਕਸਟਮਰ ਹਮੇਸ਼ਾ ਖੁਸ਼ ਰਹੂਗਾ ਅਤੇ ਮੈਂ ਉਹ ਪੀਜ਼ੇ ਕੂਪਨ ਨੂੰ ਰਿਡੀਅਮ ਕਰਕੇ ਬਹੁਤ ਖੁਸ਼ ਹੋਇਆ ਅਤੇ ਪੀਜ਼ਾ ਖਾ ਲਿਆ ਫਰੀ ਦੇ ਵਿੱਚ ਅਤੇ ਸ ਮੈਂ ਅਕਸਰ ਕਹਿੰਦਾ ਕਿ ਕੂਪਨ ਬੜਾ ਯੂਜ਼ਫੁੱਲ ਹੁੰਦਾ ਅਤੇ ਅਹਿਜੀ ਚੀਜ਼ਾਂ ਨਾਲ ਪੇ ਲੋਕ ਫਰੀ 'ਚ ਚੀਜ਼ਾਂ ਪਾ ਸਕਦੇ ਆ ਅੱਜ ਕੱਲ੍ਹ